ਕਬੱ ਕਬੱਡੀ ਮੈਚ ਪੂਰਾ ਮੈਚ ਵੀਹ ਵੀਹ ਮਿੰਟ ਦੀਆਂ ਦੋ ਵਾਰੀਆਂ ਵਿੱਚ ਖੇਡਿਆ ਜਾਂਦਾ ਹੈ ਵਾਰੀਆਂ ਦੇ ਵਿਚਕਾਰ ਪੰਜ ਮਿੰਟ ਦਾ ਸਮਾਂ ਆਰਾਮ ਲਈ ਹੁੰਦਾ ਅਤੇ ਇਸ ਵਿੱਚ ਇਸ ਵਿੱਚ ਦੋ ਟੋਲੀਆਂ ਟੋਲੀਆਂ ਵਿਚਕਾਰ ਮੈਚ ਖੇਡਿਆ ਜਾਂਦਾ ਹੈ ਅਤੇ ਦੋਨੋਂ ਟੋਲੀਆਂ ਵਿਚਕਾਰ ਸੱਤ ਸੱਤ ਖਿਡਾਰੀ ਹੁੰਦੇ ਹਨ ਕਬੱਡੀ ਮੈਨੂੰ ਬਹੁਤ ਹੀ ਪਸੰਦ ਹੈ ਇਹ ਮੈਂ ਬਚਪਨ ਵਿੱਚ ਪੰਜਵੀਂ ਕਲਾਸ ਵਿੱਚ ਖੇਡੀ ਸੀ ਅਤੇ ਇਸ ਖੇਡ ਵਿੱਚ ਮੈਨੂੰ ਬਹੁਤ ਹੀ ਮਜ਼ਾ ਆਇਆ ਸੀ ਅਤੇ ਬਹੁਤ ਜ਼ਿਆਦਾ ਪਸੰਦ ਹੈ ਮੈਨੂੰ